ਪੰਜਾਬ ਤਿਉਹਾਰ ਰੀਤੀ ਰਿਵਾਜ ਪੰਜਾਬ ਦੇ ਸਮਾਜਿਕ ਸੱਭਿਆਚਾਰਕ ਦੌਰ ਦੇ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਪੰਜਾਬ ਇਕ ਤਿਉਹਾਰਾਂ ਦਾ ਦੇਸ਼ ਹੈ ਜਿਸ ਵਿੱਚ ਲੋਹੜੀ ਦਿਵਾਲੀ ਹੋਲੀ ਹੋਰ ਕਈ ਤਿਉਹਾਰ ਮਨਾਏ ਜਾਂਦੇ ਹਨ ਜਿਵੇਂ ਪੰਜਾਬ ਦਾ ਮੁੱਖ ਤਿਉਹਾਰ ਵਿਸਾਖੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਵੱਲੋਂ ਵਿਸ਼ਾਖੀ ਵਾਲੇ ਦਿਨ ਪੰਜ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਸ਼ੁਰੂ ਕੀਤਾ ਸੀ ਉਸ ਦਿਨ ਪੰਜਾਬ ਇੱਕ ਨਵੇਂ ਪੱਖ ਤੋਂ ਉਭਰਿਆ ਸੀ ਜਿਸ ਰੀਤੀ ਰਿਵਾਜ ਚਲਦਿਆਂ ਵਿਸਾਖੀ ਦੇ ਵਿੱਚ ਰੀਤੀ ਰਿਵਾਜ ਵੀ ਸ਼ਾਮਿਲ ਹਨ ਉਸ ਦਿਨ ਤੱਕ ਕਣਕ ਦੀਆਂ ਪੱਕੀਆਂ ਫਸਲਾਂ ਵੱਢੀਆਂ ਜਾਂਦੀਆਂ ਹਨ ਵੱਢ ਕੇ ਨਬੇੜ ਦਿੱਤੀਆਂ ਜਾਂਦੀਆਂ ਹਨ ਤੇ ਕਿਸਾਨ ਖੁਸ਼ੀ ਖੁਸ਼ੀ ਵਿਸਾਖੀ ਦੇ ਤਿਉਹਾਰ ਵਿਸਾਖੀ ਦੇ ਮੇਲੇ ਤੇ ਜਾਂਦੇ ਹਨ ਹੋਰ ਵੀ ਕਈ ਤਿਹਾਰ ਜਿਵੇਂ ਲੋਹੜੀ ਦਿਵਾਲੀ ਦਿਵਾਲੀ ਵੀ ਪੰਜਾਬ ਦੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਰਿਹਾਈ ਦੇ ਨਾਲ ਜੁੜਿਆ ਹੋਇਆ ਹੈ